ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਭਾਜੀ ਪ੍ਰੋ ਅਲਟੀਮੇਟ ਕਪੂਰਥਲੇ ਤੋਂ ਬੋਲਦੇ ਹਾਂ ਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਕੋਈ ਨਾ ਕੋਈ ਨਾ ਜੀ ਹੋਜੂਗਾ ਜੀ ਸਭ ਕੁਛ ਹੋਜੂਗਾ ਜੀ ਹਾਂਜੀ ਹਾਂਜੀ ਹਾਂਜੀ ਭਾਜੀ ਹਾਂਜੀ ਹਾਂਜੀ ਭਾਜੀ ਜਿੱਦਾਂ ਨਾ ਆਪਣੀ ਜਿੰਮ ਦੀ ਫੀਸ ਹੈਗੀ ਹੈ ਸਾਲ ਦੀ ਬਾਰ੍ਹਾਂ ਹਜ਼ਾਰ ਰੁਪਇਆ ਠੀਕ ਹੈ ਬਾਰ੍ਹਾਂ ਮੰਨਥ ਹੁੰਦੇ ਉਹਦੇ 'ਚ ਅਤੇ ਆਪਾਂ ਨੂੰ ਇੱਕ ਬੈਗ ਵੀ ਫਰੀ ਮਿਲੇਗਾ ਅਤੇ ਜਿੱਦਾਂ ਤੁਸੀਂ ਮੇਰੇ ਤੋਂ ਪੀ ਟੀ ਲੈਣੀ ਆ ਪਰਸਨਲ ਟ੍ਰੇਨਿੰਗ ਲੈਣੀ ਹੈ ਉਹਦਾ ਮੈਂ ਚਾਰਜ ਕਰਦਾ ਫਿਫਟੀਨ ਹੰਡਰਡ ਰੁਪੀਸ ਪਰ ਮੰਥ ਅਤੇ ਹੁਣ ਜਿੱਦਾਂ ਕਿ ਤੁਹਾਡਾ ਵੇਟ ਕਿੰਨਾ ਹੋਊਗਾ ਭਾਜੀ ਭਾਜੀ ਫਿਰ ਤਾਂ ਜੀ ਬਹੁਤ ਠੀਕ ਹੈ ਠੀਕ ਹੈ ਠੀਕ ਆ ਭਾਜੀ ਹੁਣ ਨਾ ਜਿੱਦਾਂ ਕਿ ਤੁਸੀਂ ਵੇਟ ਲੂਜ ਕਰਨਾ ਪਹਿਲੀ ਗੱਲ ਭਾਜੀ ਤੁਹਾਨੂੰ ਆਪਣੇ ਜੀਭ 'ਤੇ ਕੰਟਰੋਲ ਕਰਨਾ ਪੈਣਾ ਜਦ ਤੱਕ ਤੁਹਾਡੀ ਜੀਭ 'ਤੇ ਕੰਟਰੋਲ ਨਹੀਂ ਹੁੰਦਾ ਨਾ ਫਿਰ ਤੁਸੀਂ ਨਹੀਂ ਕਰ ਸਕਦੇ ਹੋ ਭਾਜੀ ਪੀਉਗੇ ਉਹ ਤਾਂ ਸਭ ਤੋਂ ਮਾੜੀ ਹੈ ਜੀ ਆਪਣੇ ਲੀਵਰ 'ਤੇ ਇਫੈਕਟ ਪਾਊਗੀ ਜੀ ਸਾਡੇ ਆਪਣੇ ਹਾਜਮੇ 'ਤੇ ਫੈਕਟ ਪਾਉਗੀ ਆਪਣਾ ਹਾਜਮਾ ਖ਼ਰਾਬ ਹੋ ਗਿਆ ਉਹਦੇ ਕਰਕੇ ਫਿਰ ਤੁਹਾਨੂੰ ਸ਼ਰੀਰ ਨੂੰ ਲੱਗਣਾ ਨਹੀਂ ਕੁਛ ਭਾਜੀ ਫਿਰ ਤੁਹਾਡੀ ਜਿੰਮ ਕਹੋਗੇ ਵੇਟ ਨੇ ਲੱਗਣਾ ਜੀ ਬਾਈ ਜਿੱਦਾਂ ਕਿ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਹੈ ਕਿ ਆਪਾਂ ਨੂੰ ਕਿ ਕਿਆ ਕਰਨਾ ਪੈਣਾ ਜੀ ਜਿੱਦਾਂ ਭਾਜੀ ਤੁਹਾਨੂੰ ਰੋਜ਼ ਤੁਹਾਨੂੰ ਡਾਇਟ ਪਲੈਨ ਮੈਂ ਦੱਸ ਦਿੰਨਾ ਹੈ ਜੇ ਤੁਸੀਂ ਮੇਰੇ ਕੋਲ ਪੀ ਟੀ ਕਰਨਾ ਚਾਹੁੰਦੇ ਜੀ ਤਾਂ ਭਾਜੀ ਤੁਸੀਂ ਰੋਜ਼ ਸੁਬਹ ਉੱਠ ਕੇ ਪਹਿਲਾਂ ਤਾਂ ਜੀ ਗਰਮ ਗਲਾਸ ਪਾਣੀ ਦਾ ਲੈ ਕੇ ਵਿੱਚ ਸ਼ਹਿਦ ਪਾ ਕੇ ਅਤੇ ਕਾਲੀ ਮਿਰਚ ਪਾ ਕੇ ਤੁਸੀਂ ਪੀਣਾ ਹੈ ਸਿਪ ਸਿਪ ਕਰਕੇ ਹਾਂਜੀ ਸਭ ਤੋਂ ਸਟਾਟਿੰਗ ਦਾ ਕੰਮ ਇਹ ਕਰਨਾ ਤੁਸੀਂ ਉਹ ਹੀ ਸੱਤ ਤੋਂ ਅੱਠ ਦੇ ਵਿੱਚ ਵਿੱਚ ਫਿਰ ਤੁਸੀਂ ਸੁਬਹਾ ਨੌਂ ਵਜੇ ਭਾਜੀ ਪੋਹਾ ਹੋ ਗਿਆ ਜਾਂ ਫਿਰ ਇੱਦਾਂ ਹੀ ਹੈਲਦ ਪੋਹਾ ਲੈ ਲਓ ਤੁਸੀਂ ਪੋਹਾ ਬਣਾ ਕੇ ਖਾ ਸਕਦੇ ਹੋ ਜਾਂ ਦਲੀਆ ਖਾ ਸਕਦੇ ਹੋ ਮਿੱਠਾ ਦਲੀਆ ਨਹੀਂ ਖਾਣਾ ਭਾਜੀ ਉਹਦੇ ਕਰਕੇ ਸ਼ੁ ਆਪਣਾ ਜਿਹੜਾ ਫੈਟ ਹੈ ਨਾ ਜੀ ਉਹ ਲੂਜ਼ ਹੋ ਜਾਂਦਾ ਫਿਰ ਉਹ ਲਮਕਣ ਲੱਗ ਪੈਂਦਾ ਜਿੱਦਾਂ ਤੁਹਾਡਾ ਢਿੱਡ ਲਮਕਦਾ ਹੋਣਾ ਨਾ ਥੱਲੇ ਭਾਜੀ ਓ ਭਾਈ ਮਿੱਠੇ ਕਰਕੇ ਹੁੰਦਾ ਤੁਹਾਨੂੰ ਮਿੱਠਾ ਬਿਲਕੁਲ ਹੀ ਬੰਦ ਕਰਨਾ ਪੈਣਾ ਅੱਜ ਤੋੰ ਤੁਸੀਂ ਸ਼ੁਰੂ ਕਰ ਦਿਓ ਤੁਸੀਂ ਇੱਕ ਦਾਣਾ ਤੱਕ ਤੁਹਾਡੇ ਲਈ ਜਹਿਰ ਹੈ ਚੀਨੀ ਬਾਈ ਹਾਂਜੀ ਤੁਹਾਨੂੰ ਮਿੱਠਾ ਬਿਲਕੁਲ ਹੀ ਖ਼ਤਮ ਕਰਨਾ ਪੈਣਾ ਜੀ ਹਾਂਜੀ ਭਾਜੀ ਹਾਂਜੀ ਭਾਜੀ ਹਾਂਜੀ ਅਤੇ ਭਾਜੀ ਚੀਨੀ ਤੁਹਾਨੂੰ ਬਿਲਕੁਲ ਬੰਦ ਕਰਨੀ ਪੈਣੀ ਤੁਸੀਂ ਅਤੇ ਸੁਬਹਾ ਪੋਹਾ ਖਾ ਸਕਦੇ ਦਲੀਆ ਖਾ ਸਕਦੇ ਇਹਦੇ ਚੋਂ ਇੱਕ ਚੀਜ਼ ਹੀ ਖਾਣੀ ਹੈ ਨੌਂ ਤੋਂ ਦਸ ਦੇ ਵਿੱਚ ਵਿੱਚ ਅਤੇ ਤੁਸੀਂ ਦੁਪਹਿਰ ਨੂੰ ਬਾਰ੍ਹਾਂ ਕੁ ਵਜੇ ਤੁਸੀਂ ਉਹ ਫਰੂਟ ਲੈ ਲੈਣੇ ਫਰੂਟ ਖਾ ਲੈਣੇ ਮਾੜੇ ਮੋਟੇ ਸੈਲਡ ਲੈ ਲਾਣਾ ਸੈਲਡ ਖਾ ਲੈਣਾ ਮਾੜਾ ਮੋਟਾ ਦੁਪਹਿਰ ਨੂੰ ਫਿਰ ਤੁਸੀਂ ਇੱਕ ਤੋਂ ਦੋ ਦੇ ਵਿੱਚ ਵਿੱਚ ਤੁਸੀਂ ਬਰਾਊਣ ਰਾਈਸ ਖਾ ਸਕਦੇ ਹੋ ਨਾਲ ਸੈਲਡ ਖਾ ਸਕਦੇ ਹੋ ਨਾਲ ਉਬਲੇ ਹੋਏ ਮਤਲਬ ਕਿ ਵੈਜੀ ਵੈਜੀਟੇਬਲ ਖਾ ਸਕਦੇ ਹੋ ਤੁਸੀਂ ਕੁਛ ਵੀ ਓਇਲ ਹਾਂਜੀ ਹਾਂਜੀ ਹਾਂਜੀ ਹਾਂਜੀ ਬੋਇਲ ਚਿਕਨ ਖਾ ਸਕਦੇ ਹੋ ਭਾਜੀ ਤੁਸੀਂ ਬੋਇਲਡ ਐ ਇਹ ਮੈਂ ਤੁਹਾਨੂੰ ਵੈਜੀਟੇਰਿਅਨ ਤਾਂ ਦੱਸ ਰਿਹਾ ਕਿ ਤੁਸੀਂ ਫੈਟ ਲੂਜ ਕਰਨਾ ਹੈ ਤੁਸੀਂ ਗੇਨ ਨਹੀਂ ਕਰਨਾ ਹੈ ਭਾਜੀ ਹਾਂਜੀ ਠੀਕ ਹੈ ਜੀ ਠੀਕ ਹੈ ਓਕੇ ਜੀ